ਅੱਜ ਸਵੇਰੇ ਜਲਦੀ ਜਲਦੀ ਵਿੱਚ ਘਰੋਂ ਆਉਣ ਵੇਲੇ ਮੈਂ ਆਪਣਾ ਲੰਚ ਬੋਕਸ ਘਰ ਭੁੱਲ ਆਇਆ ਅਤੇ ਜਦੋਂ ਦੁਪਹਿਰ ਵੇਲੇ ਖਾਣਾ ਖਾਣ ਦਾ ਸਮੇਂ ਆਇਆ ਤਾਂ ਮੈਂ ਤਾਂ ਮੈਂ ਨੇ ਜਮੈਂਟੋ ਐਪ ਡਾਊਨਲੋਡ ਕਰੀ ਐਪ ਡਾਊਨਲੋਡ ਕਰਕੇ ਮੈਂ ਉਸ ਉੱਪਰ ਆਪਣਾ ਖਾਣਾ ਔਡਰ ਕਰਿਆ ਜਿਸ ਵਿੱਚ ਮੈਨੇ ਇੱਕ ਦਾਲ ਮੱਖਣੀ ਮਿਕਸ ਵੈੱਜ ਰਾਈਸ ਸਲਾਦ ਦੋ ਚਪਾਤੀ ਅਤੇ ਸਵੀਟਸ ਔਡਰ ਕਰਿਆ ਅਤੇ ਉਸ ਔਡਰ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਜਮੈਂਟੋ ਬੁਆਏ ਮੇਰਾ ਖਾਣਾ ਲੈ ਕੇ ਆ ਗਿਆ ਅਤੇ ਮੈਨੇ ਅਤੇ ਮੈਨੇ ਉਸ ਨੂੰ ਪੇਮੈਂਟ ਕੀਤੀ ਅਤੇ ਆਪਣਾ ਖਾਣਾ ਇੰਜੋਏ ਕਰਿਆ ਕ ਖਾਣਾ ਖਾਣ ਤੋਂ ਬਾਅਦ ਮੈਂ ਭੁੱਲ ਗਿਆ ਸੀ ਕਿ ਮੈਂ ਜਮੈਂਟੋ ਬੁਆਏ ਤੋਂ ਆਪਣੀ ਪੇਮੈਂਟ ਸਲਿੱਪ ਲੈਣੀ ਭੁੱਲ ਗਿਆ ਅਤੇ ਉਸ ਤੋਂ ਬਾਅਦ ਮੈਂ ਜਮੈਂਟੋ ਦੀ ਸਾਈਟ 'ਤੇ ਗਿਆ ਸਾਈਟ 'ਤੇ ਜਾ ਕੇ ਮੈਨੇ ਦੁਬਾਰਾ ਤੋਂ ਆਪਣੀ ਸਲਿੱਪ ਡਾਊਨਲੋਡ ਕਰੀ ਅਤੇ ਉਸਨੂੰ ਅਕਾਊਂਟ ਬਣਾਉਣ ਦੇ ਵਿੱਚ ਆਪਣੇ ਕੋਂਟ ਦੀ ਅਕਾਊਂਟ ਬਣਾਉਣ ਦੇ ਵਿੱਚ ਕੈਸ਼ ਪੇਮੈਂਟ ਲੈਣ ਲਈ ਪ੍ਰੋਸੈਸ ਵਿੱਚ ਲਗਾ ਦਿੱਤੀ